ਪੰਜਾਬੀ ਭਾਸ਼ਾ ਨੇ ਹੋਰ ਭਾਸ਼ਾਵਾਂ ਦੇ ਖੇਤਰ ਵਿੱਚ ਬਹੁਤ ਵਿਕਾਸ ਕੀਤਾ ਹੈ ਜਿਵੇਂ ਪੂਰੇ ਵਿਸ਼ਵ ਵਿੱਚ ਜੋ ਹੈ ਪੰਜਾਬੀ ਲਿਟਰੇਚਰ ਉਹ ਬਹੁਤ ਪ੍ਰਸਿੱਧ ਹੈ ਪੰਜਾਬੀ ਗਾਣੇ ਪੰਜਾਬੀ ਫ਼ਿਲਮਾਂ ਸਾਰੇ ਵਿਸ਼ਵ ਦੇ ਲੋਕ ਪਸੰਦ ਕਰਦੇ ਹਨ ਦੂਜੇ ਰਾਜਾਂ ਤੋਂ ਆਏ ਲੋਕ ਜਿਵੇਂ ਬਿਹਾਰ ਤੋਂ ਯੂ ਪੀ ਤੋਂ ਅਤੇ ਦੱਖਣੀ ਭਾਰਤ ਤੋਂ ਜਿਹੜੇ ਲੋਕ ਆ ਕੇ ਪੰਜਾਬ ਵਿੱਚ ਰਹਿ ਰਹੇ ਹਨ ਉਹ ਵੀ ਪੰਜਾਬੀ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਕਿ ਪੰਜਾਬੀ ਬੋਲਣ ਲੱਗ ਗਏ ਹਨ ਅਤੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਵੀ ਆਪਣੇ ਜੀਵਨ ਦਾ ਇੱਕ ਜ਼ਰੂਰੀ ਅੰਗ ਬਣਾ ਲਿਆ ਹੈ ਸਾਰੇ ਵਿਸ਼ਵ ਵਿੱਚ ਪੰਜਾਬੀ ਭਾਸ਼ਾ ਜੋ ਹੈ ਉਹ ਬਾਕੀ ਭਾਸ਼ਾਵਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ